ਅਸੀਂ ਆਪਣੇ ਖੇਤਰ ਵਿੱਚ ਜਿਹੜੇ ਵੀ ਵਿਦਿਆਰਥੀ ਹੁੰਦੇ ਹਨ ਸਕੂਲ ਹੋਵੇ ਜਾਂ ਕਾਲਜ ਅਸੀਂ ਉਹਨਾਂ ਨੂੰ ਉਹਨਾਂ ਦੇ ਮਨਪਸੰਦ ਪ੍ਰੋਜੈਕਟ ਜ ਪ੍ਰੋਜੈਕਟ ਵਿੱਚ ਕੋਰਸ ਰਾਹੀਂ ਉਹਨਾਂ ਨੂੰ ਜਾਣਕਾਰੀ ਦੇ ਕੇ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਕੋਰਸਾਂ ਵਿੱਚ ਪਰਫੈਕਟ ਕਰਦੇ ਹਨ ਤਾਂ ਜੋ ਕੋਰਸ ਦੀ ਡਿਗਰੀ ਪ੍ਰਾਪਤ ਕਰਕੇ ਆਪਣੇ ਜੀਵਨ ਵਿੱਚ ਨੌਕਰੀ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਣ ਅਤੇ ਆ ਕੁਝ ਮੁਕਾਮ ਹਾਸਿਲ ਕਰ ਸਕਣ